ਹਾਂਜੀ ਦੋਸਤੋ ਹਰ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਚੁਣੌਤੀ ਆਉਂਦੀ ਹੈ ਅਤੇ ਉਸਨੂੰ ਉਸਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇੱਕ ਬਹੁਤ ਹੀ ਵੱਡੀ ਚੁਣੌਤੀ ਆਈ ਸੀ ਜਿਹੜੀ ਕਿ ਸੀ ਮੇਰੀ ਬਿਮਾਰੀ ਮੇ ਮੈਨੂੰ ਆਪਣੀ ਬਿਮਾਰੀ ਦੇ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਟਾਈਮ ਐਸਾ ਆਇਆ ਸੀ ਕਿ ਮੈਂ ਬਹੁਤ ਹੀ ਜ਼ਿਆਦਾ ਬਿਲਕੁਲ ਨਿਰਾਸ਼ ਹੋ ਗਈ ਸੀ ਅਤੇ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਸ਼ਾਇਦ ਅੱਗੇ ਹੋਰ ਵੀ ਨਹੀਂ ਜੀ ਪਾਉਂਗੀ ਕਿਉਂਕਿ ਉਸਦੇ ਵਿੱਚ ਐਸੀ ਬਿਮਾਰੀ ਮੈਨੂੰ ਹੋ ਗਈ ਸੀ ਕਿ ਮੈਂ ਬਿਲਕੁਲ ਬੈੱਡ 'ਤੇ ਹੀ ਆ ਗਈ ਸੀ ਔਰ ਮੇਰਾ ਚੱਲਣਾ ਫਿਰਨਾ ਵੀ ਮੁਹਾਲ ਹੋ ਗਿਆ ਸੀ ਔਰ ਮੈਂ ਦੂਸਰਿਆਂ 'ਤੇ ਹੀ ਮੁਹਤਾਜ ਹੋ ਗਈ ਸੀ ਆਪਣੇ ਛੋਟੇ ਛੋਟੇ ਕੰਮਾਂ ਦੇ ਲਈ ਵੀ ਚਾਹੇ ਛੋਟਾ ਜਾਂ ਕੁਛ ਮਤਲਬ ਗਿਲਾਸ ਤੱਕ ਵੀ ਮੈਂ ਉਠਾ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਆਪਣੇ ਜੋੜਾਂ ਦੇ ਦਰਦ ਮੇਰੇ ਪੂਰੇ ਸਰੀਰ ਵਿੱਚ ਹੁੰਦੇ ਸੀ ਅਤੇ ਜਿਹੜੀ ਕਿ ਇੱਕ ਬਹੁਤ ਹੀ ਜ਼ਿਆਦਾ ਭਿਅੰਕਰ ਬਿਮਾਰੀ ਹੁੰਦੀ ਹੈ ਜਿਸਦੇ ਵਿੱਚ ਜਿਹੜਾ ਇਨਸਾਨ ਹੈ ਬਿਲਕੁਲ ਵੀ ਹਿੱਲਜੁੱਲ ਨਹੀਂ ਸਕਦਾ